ਮੇਰਾ ਜਨਮ ਪੰਜਾਬ ਵਿੱਚ ਹੋਇਆ ਹੈ ਅਤੇ ਮੇਰੀ ਮਾਂ ਬੋਲੀ ਪੰਜਾਬੀ ਹੈ ਪੰਜਾਬੀ ਤੋਂ ਹੀ ਮੈਨੂੰ ਪਹਿਚਾਣ ਮਿਲੀ ਹੈ ਪੰਜਾਬੀ ਭਾਸ਼ਾ ਦੇ ਸੱਭਿਆਚਾਰ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਸਾਰੇ ਸੱਭਿਆਚਾਰਿਕ ਰੀਤੀ ਰਿਵਾਜ਼ ਅਤੇ ਰਸਮਾਂ ਜੋ ਵੀ ਹਨ ਉਹ ਪੰਜਾਬ ਵਿੱਚ ਹੀ ਮਨਾਏ ਜਾਂਦੇ ਹਨ ਇਹ ਇੱਕ ਪੰਜਾਬ ਦੀ ਹੀ ਦੇਣ ਹੈ ਪੰਜਾਬੀ ਸੱਭਿਆਚਾਰ ਇੱਕ ਅ ਪੰਜਾਬੀ ਲੋਕ ਸਮੂਹ ਦੁਆਰਾ ਸਿਰਜਿਆ ਗਿਆ ਹੈ ਪੰਜਾ ਅ ਇ ਜਿਵੇਂ ਕਿ ਇਸ ਵਿੱਚ ਰਹਿਣ ਸਹਿਣ ਰਸਮ ਰਿਵਾਜ਼ ਰਿਸ਼ਤੇ ਨਾਤੇ ਪਰਿਵਾਰ ਮੰਨੋਰੰਜਨ ਸਾਧਨ ਲੋਕ ਸਾਹਿਤ ਆਦਿ ਸ਼ਾਮਿਲ ਹਨ ਓਪਰੀ ਨਜ਼ਰ ਵੇਖੀਏ ਤਾਂ ਤਾਂ ਜਿਹੜਾ ਸੱਭਿਆਚਾਰ ਹੈ ਉਹ ਇੱਕ ਤਰ੍ਹਾਂ ਨਾਲ ਸਧਾਰਨ ਜਾਪਦਾ ਹੈ ਪਰ ਅਸਲ ਵਿੱਚ ਇਹ ਇ ਇੰਨਾਂ ਸਰਲ ਨਹੀਂ ਹੈ ਇਹ ਇੱਕ ਤਰ੍ਹਾਂ ਨਾਲ ਆਪਣੇ ਆਪ ਵਿੱਚ ਜਟਿਲ ਵਰਤਾਰਾ ਹੈ ਅਸਲ ਵਿੱਚ ਇਹ ਕੌਮ ਜਨ ਸਮੂਹ ਜਾਂ ਸਮਾਜ ਦੇ ਨਾਂ ਨਾਲ਼ ਜਾਣਿਆ ਜਾਂਦਾ ਇਹ ਸੱਭਿਆਚਾਰ ਤੋਂ ਸੱਖਣਾ ਨਹੀਂ ਹੁੰਦਾ ਭਾਵ ਉਹ ਵਿਕਾਸ ਦੇ ਕਿਸੇ ਵੀ ਪੜਾਅ 'ਤੇ ਹੋ ਸਕ